ਭਾਰਤ ਉੱਦਮੀਆਂ ਲਈ ਇੱਕ ਉੱਭਰਦੇ ਯੁੱਗ ਦਾ ਆਨੰਦ ਮਾਣ ਰਿਹਾ ਜੇ ਦੇਖਿਆ ਜਾਵੇ ਤਾਂ ਭਾਰਤ ਸਰਕਾਰ ਨੇ ਬਹੁਤ ਸਾਰੀਆਂ ਅਜਿਹੀਆਂ ਸਕੀਮਾਂ ਕੱਢੀਆਂ ਜਿਹੜੀਆਂ ਕਿ ਉੱਦਮੀਆਂ ਲਈ ਲਾਹੇਵੰਦ ਹੈਗੀਆਂ ਨੇ ਜਿਵੇਂ ਕਿ ਇੱਕ ਐੱਮ ਐੱਸ ਐੱਮ ਈ ਸਕੀਮ ਹੈ ਮਾਈਕਰੋ ਸਮੋਲ ਅਤੇ ਮੀਡੀਅਮ ਐਂਟਰਪ੍ਰਾਈਜ ਹੁੰਦੀਆਂ ਨੇ ਉਹਦੇ ਲਈ ਸਕੀਮ ਹੈ ਜਿਹਦੇ ਵਿੱਚ ਕਿ ਦਸ ਲੱਖ ਤੱਕ ਦਾ ਲੋਨ ਬਿਨਾਂ ਕੁਝ ਵੀ ਗਿਰਵੀ ਰੱਖੀ ਮਿਲ ਜਾਂਦਾ ਉਹਦੇ ਲਈ ਸਿਰਫ ਆਪਣੇ ਕਾਰੋਬਾਰ ਦੇ ਡਾਕੂਮੈਂਟ ਲਾਉਣੇ ਪੈਂਦੇ ਹੋਰ ਕੁਝ ਵੀ ਨਹੀਂ ਅਤੇ ਨਾ ਕੋਈ ਉਹਦਾ ਬਹੁਤਾ ਲੈਂਥੀ ਪ੍ਰੋਸੀਜਰ ਹੈ ਨਾ ਹੀ ਬਹੁਤਾ ਉਹਦੇ ਉੱਤੇ ਵਿਆਜ ਪੈਂਦਾ ਸੋ ਜੇ ਇਤੋਂ ਇਲਾਵਾ ਦੇਖਿਆ ਜਾਵੇ ਤਾਂ ਜੇ ਮੰਨ ਲਓ ਐਗਰੋ ਦੇ ਨਾਲ ਰਿਲੇਟਡ ਕੋਈ ਬਿਜ਼ਨਸ ਸ਼ੁਰੂ ਕਰਦਾ ਤਾਂ ਉਹਨੂੰ ਪੱਚੀ ਲੱਖ ਤੱਕ ਦਾ ਵੀ ਲੋਨ ਮਿਲਦਾ ਉਹਤੋਂ ਇਲਾਵਾ ਸਬਸਿਡੀਆਂ ਵੀ ਮਿਲਦੀਆਂ ਇਹੋ ਜਿਹੀਆਂ ਹੀ ਸਕੀਮਾਂ ਵੀ ਪਈਆਂ ਕਰੋੜਾਂ ਰੁਪਈਆ ਵੀ ਸਰਕਾਰ ਦੇ ਰਹੀ ਅੱਜ ਦੀ ਤਰੀਕ ਦੇ ਵਿੱਚ ਕਿ ਕਾਰੋਬਾਰ ਸ਼ੁਰੂ ਕਰੋ ਬਸ ਸੋ ਦੇਖਿਆ ਜਾਵੇ ਕਿਤੇ ਨਾ ਕਿਤੇ ਸਰਕਾਰ ਮਦਦ ਬਹੁਤ ਕਰ ਰਹੀ ਹੈ ਬਸ ਲਾਹਾ ਲੈਣਾ ਕਿਵੇਂ ਆ ਇਹ ਆਉਣਾ ਚਾਹੀਦਾ ਬੰਦੇ ਨੂੰ